ਜੇਕਰ ਪੰਜਾਬ ਦੇ ਇਤਿਹਾਸ ਦੀ ਗੱਲ ਕੀਤੀ ਜਾਏ ਤਾਂ ਪੰਜਾਬ ਦਾ ਇਤਿਹਾਸ ਜਿਹੜਾ ਹੈ ਉਹ ਧਾਰਮਿਕ ਵੀ ਰਿਹਾ ਯੁੱਧਾਂ ਵਾਲਾ ਵੀ ਰਿਹਾ ਲੜਾਈਆਂ ਵਾਲਾ ਵੀ ਰਿਹਾ ਆਪਸ ਭਾਈਚਾਰੇ ਵਾਲਾ ਵੀ ਰਿਹਾ ਏਕਤਾ ਵਾਲਾ ਵੀ ਰਿਹਾ ਹਰ ਤਰ੍ਹਾਂ ਦਾ ਜਿਹੜਾ ਇਤਿਹਾਸ ਜਿਹੜਾ ਹਰ ਤਰ੍ਹਾਂ ਦੀ ਜੋ ਤੁਹਾਡੀ ਸੋਚ ਹੈ ਜੋ ਤੁਹਾਡਾ ਦੇਖ ਸਭ ਕੁਛ ਹੈ ਉਹ ਤੁਹਾਨੂੰ ਪੰਜਾਬ ਦੇ ਇਤਿਹਾਸ ਵਿੱਚ ਮਿਲ ਜਾਏਗਾ ਪੰਜਾਬ ਦੇ ਵਿੱਚ ਗੁਰੂ ਸਾਹਿਬ ਵੀ ਆਏ ਹੈ ਮਹਾਰਾਜਾ ਰਣਜੀਤ ਸਿੰਘ ਵਰਗੇ ਰਾਜੇ ਵੀ ਆਏ ਹੈ ਮੁਸਲਮਾਨ ਵੀ ਆਏ ਹੈ ਬ੍ਰਿਟਿਸ਼ ਵਾਲਿਆਂ ਦਾ ਵੀ ਰਾਜ ਰਿਹਾ ਉਸ ਤੋਂ ਇਲਾਵਾ ਹੋਰ ਵੀ ਬਹੁਤ ਕੁਛ ਹੋਇਆ ਬਹੁਤ ਜ਼ਿਆਦਾ ਜਿਹੜਾ ਏਰੀਆ ਸੀਗਾ ਪੰਜਾਬ ਨੂੰ ਦੋ ਤਿੰਨ ਵਾਰੀ ਡਿਵਾਇਡ ਹੋ ਚੁੱਕਿਆ ਪਹਿਲਾਂ ਪੰਜਾਬ ਜਿਹੜਾ ਉਹ ਕੱਟਿਆ ਗਿਆ ਜੀ ਜਦੋਂ ਪਾਕਿਸਤਾਨ ਬਣਿਆ ਉੱਨੀ ਸੌ ਸੰਤਾਲੀ ਦੇ ਵਿੱਚ ਇੱਕ ਨਵੰਬਰ ਉੱਨੀ ਸੋ ਛਿਆਹਠ ਦੇ ਵਿੱਚ ਫਿਰ ਪੰਜਾਬ ਦੀ ਵੰਡ ਹੋ ਗਈ ਜਦੋਂ ਹਿਮਾ ਹਰਿਆਣਾ ਪੰਜਾਬ ਚੰਡੀਗੜ੍ਹ ਵੱਖਰੇ ਹੋਏ ਸੋ ਜੇਕਰ ਆਪਾਂ ਗੱਲ ਕਰੀਏ ਉਹਦੀ ਏਰੀਏ ਦੀ ਤਾਂ ਕਾਫ਼ੀ ਵਾਰੀ ਪੰਜਾਬ ਜਿਹੜਾ ਉਹ ਡਿਵਾਈਡ ਵੀ ਹੋਇਆ ਵੱਖਰੇ ਵੱਖਰੇ ਪੰਜਾਬ ਨੂੰ ਨਾਮ ਦਿੱਤੇ ਗਏ ਹੈ ਪੰਜਾਬ ਜਿਹੜਾ ਉਹ ਪੰਜ ਨਦੀਆਂ ਦਾ ਮੇਲ ਸੀਗਾ ਜਿਹਦੇ 'ਚੋਂ ਕਿ ਢਾਈ ਜਿਹੜੀਆਂ ਓਧਰ ਪਾਕਿਸਤਾਨ ਚਲੀ ਗਈਆਂ ਢਾਈ ਪੰਜਾਬ 'ਚ ਰਹਿ ਗਈਆਂ ਜਿਹੜਾ ਮੌਜੂਦਾ ਪੰਜਾਬ ਹੈ ਉਸ ਤੋਂ ਇਲਾਵਾ ਪੰਜਾਬ ਇੱਕ ਰਿਚ ਰਿਚੈਸਟ ਸਟੇਟ ਵੀ ਹੈ ਕਿ ਬਹੁਤ ਜ਼ਿਆਦਾ ਪੈਸਾ ਵੀ ਪੰਜਾਬ ਦੇ ਵਿੱਚ ਅਵੇਲੇਬਲ ਹੈ ਜ਼ਮੀਨ ਕਾਫ਼ੀ ਅਵੇਲੇਬਲ ਹੈ ਲੋਕ ਖੇਤੀ ਜਿਹੜਾ ਇਹਦਾ ਮੁੱਖ ਇਨਕਮ ਦਾ ਸਰੋਤ ਹੈ ਪੋਪੂਲੇਸ਼ਨ ਜਿਹੜੀ ਹੈਗੀ ਹੈ ਉਹ ਵੀ ਕਾਫ਼ੀ ਪੰਜਾਬ ਦੀ ਸਹੀ ਹੈਗੀ ਐ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਕ ਵਿਜਿਟਿੰਗ ਪਲੇਸਾਂ ਵੀ ਕਾਫ਼ੀ ਨਵੀਆਂ ਨਵੀਆਂ ਬਣ ਗਈਆਂ ਕਾਫ਼ੀ ਤੁਸੀਂ ਘੁੰਮਣ ਫਿਰਨ ਜਾ ਸਕਦੇ ਹੋ ਔਰ ਕੁਛ ਪੁਰਾਣੀਆਂ ਵੀ ਇਤਿਹਾਸਕ ਵੀ ਇਮਾਰਤਾਂ ਕਾਫ਼ੀ ਪ ਪੰਜਾਬ ਦੇ ਵਿੱਚ ਹੈਗੀਆਂ